ਤੁਸੀਂ ਬੱਚਿਆਂ ਨੂੰ ਅਖਬਾਰ ਪੜ੍ਹਨ ਲਈ ਕਿੰਨੀ ਵਾਰ ਉਤਸਾਹਿਤ ਕਰਦੇ ਹੋ ਕਿ ਉਸ ਉਹਨਾਂ ਨੂੰ ਪੜ੍ਹਦੇ ਹੋ ਜਾਂ ਕਿ ਉਹਨਾਂ ਉਹ ਤੁਹਾਨੂੰ ਪੜ੍ਹਾਉਂਦੇ ਹਨ ਮੈਂ ਬੱਚਿਆਂ ਨੂੰ ਖਾਣ ਪਾਣ ਲਈ ਹਰ ਰੋਜ਼ ਉਤਸਾਹਿਤ ਕਰਦਾ ਹਾਂ ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਅਖਬਾਰਾਂ ਪੜ੍ਹਨ ਨਾਲ ਉਹਨਾਂ ਦਾ ਗਿਆਨ ਵੱਧਦਾ ਹੈ ਅਤੇ ਉਹ ਦੁਨੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਮੈਂ ਉਹਨਾਂ ਨੂੰ ਖੁਦ ਅਖਬਾਰਾਂ ਪੜ੍ਹ ਕੇ ਸੁਣਾਉਂਦਾ ਹਾਂ ਕਿ ਉਹ ਮੈਨੂੰ ਪੜ੍ਹਨ ਕੀ ਪੜ੍ਹਨ ਲਈ ਕਹਿੰਦੇ ਹਨ ਮੈਂ ਚਾਹੁੰਦਾ ਹਾਂ ਕਿ ਉਹ ਅਖਬਾਰਾਂ ਪੜ੍ਹਨ ਅਤੇ ਕੇ ਆਪਣੀ ਸੋਚ ਵਿਕਸਿਤ ਕਰਨ ਅਤੇ ਦੁਨੀਆਂ ਦੀ ਸਭ ਤੋਂ ਜੁੜੇ ਰਹਿਣ ਧੰਨਵਾਦ